ਪਿੰਡਾਂ ਵਿੱਚ ਵੈਸੇ ਤਾਂ ਗਲੇ ਨੂੰ ਠੀਕ ਕਰਨ ਦੇ ਬਹੁਤ ਸਾਰੇ ਨੁਸਖੇ ਹੈਗੇ ਹੈ ਉਹਨਾਂ ਵਿੱਚ ਇੱਕ ਦੋ ਬੜੇ ਫੇਮਸ ਨੁਸਖੇ ਹੈ ਉਹ ਤੁਹਾਨੂੰ ਮੈਂ ਤੁਹਾਡੇ ਨਾਲ ਮੈਂ ਸਾਂਝੇ ਕਰਨ ਲੱਗਿਆ ਏ ਉਹਦੇ ਵਿੱਚ ਹੈਗਾ ਏ ਇੱਕ ਤਾਂ ਜਿਹੜਾ ਗਰਮ ਪਾਣੀ ਕਰਕੇ ਉਹਨੂੰ ਉਬਾਲੀ ਦੇ ਕੇ ਉਹਦੇ ਵਿੱਚ ਨੂਣ ਪਾ ਕੇ ਉਹਨੂੰ ਜਦ ਤੱਕ ਉਹ ਨੋਰਮਲ ਟੈਂਪਰੇਚਰ 'ਤੇ ਕਰਕੇ ਉਹਨੂੰ ਉਹਦੇ ਗਰਾਲ਼ੇ ਕੀਤੇ ਜਾਂਦੇ ਹੈਗੇ ਹੈ ਇਹਦੇ ਨਾਲ ਗਲਾ ਆਰਾਮ ਨਾਲ ਤੁਹਾਡਾ ਠੀਕ ਹੋ ਸਕਦਾ ਹੈਗਾ ਏ ਅਤੇ ਨੰਬਰ ਦੋ 'ਤੇ ਜਿਹੜਾ ਠੰਡਾ ਪਾਣੀ ਪੀਣ ਤੋਂ ਪਰਹੇਜ਼ ਕੀਤਾ ਜਾਂਦਾ ਹੈਗਾ ਏ ਸਾਦਾ ਪਾਣੀ ਪੀਤਾ ਜਾਂਦਾ ਹੈਗਾ ਏ ਇਹ ਸਾਡੇ ਉਹ ਫਰੀ ਵਾਲੇ ਨੁਸਖੇ ਹੈਗੇ ਇਹਦੇ ਨਾਲ ਸਾਨੂੰ ਦਵਾਈਆਂ ਵਗੈਰਾ ਦੀ ਕੋਈ ਲੋੜ ਨਹੀਂ ਪੈਂਦੀ ਹੈਗੀ ਹੈ